ਅਜੋਕੇ ਜ਼ਮਾਨੇ ਵਿੱਚ ਪੰਜਾਬ ਦੇ ਵਿੱਚ ਮਨੋਰੰਜਨ ਉਦਯੋਗ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ ਮਨੋਰੰਜਨ ਉਦਯੋਗ ਤਾਂ ਬਿਨਾਂ ਪਿੱਛੇ ਮੁੜ ਕੇ ਦੇਖੇ ਅੱਗੇ ਤੋਂ ਅੱਗੇ ਵੱਧਦਾ ਜਾ ਰਿਹਾ ਹੈ ਇਹਦੇ ਵਿੱਚ ਗਾਣੇ ਆ ਰਹੇ ਨੇ ਫਿਲਮਾਂ ਆ ਰਹੀਆਂ ਨੇ ਬਹੁਤ ਵਧੀਆ ਤਰੀਕੇ ਲੋਕਾਂ ਦਾ ਮਨੋਰੰਜਨ ਕਰਦੀਆਂ ਨੇ ਜਿਹੜੇ ਲੋਕ ਪੰਜਾਬੀ ਫਿਲਮਾਂ ਨੂੰ ਭੁੱਲ ਚੁੱਕੇ ਸੀ ਪੰਜਾਬੀ ਗਾਣਿਆਂ ਨੂੰ ਭੁੱਲ ਚੁੱਕੇ ਸੀਗੇ ਅੱਜ ਦੇ ਜ਼ਮਾਨੇ ਦੇ ਵਿੱਚ ਮਨੋਰੰਜਨ ਉਦਯੋਗ ਨੇ ਬਹੁਤ ਜ਼ਿਆਦਾ ਆਪਣਾ ਇਹਦੇ ਵਿੱਚ ਕੰਮ ਕੀਤਾ ਹੈ ਫਿਲਮਾਂ ਦਿਨ ਬ ਦਿਨ ਆ ਰਹੀਆਂ ਨੇ ਬਹੁਤ ਸੋਹਣੀਆਂ ਫਿਲਮਾਂ ਬਣ ਰਹੀਆਂ ਨੇ ਬਹੁਤ ਲੋਕ ਮਨੋਰੰਜਨ ਕਰਦੇ ਨੇ ਸਪੈਸ਼ਲ ਸਿਨਮੇ ਵਿੱਚ ਜਾ ਕੇ ਫਿਲਮ ਦੇਖਣੀ ਪਸੰਦ ਕਰ ਰਹੇ ਨੇ ਅਤੇ ਗਾਣੇ ਨਿੱਤ ਨਵੇਂ ਆ ਰਹੇ ਨੇ ਔਰ ਉਹਨਾਂ ਗਾਣਿਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਜਿਸਦਾ ਕਿ ਸਾਡੇ ਪੰਜਾਬ ਦੀ ਇਕੋਨਮੀ 'ਤੇ ਬਹੁਤ ਜ਼ਿਆਦਾ ਅਸਰ ਪਿਆ ਹੈ ਅਤੇ ਇਸ ਤੋਂ ਇਲਾਵਾ ਲੋਕਾਂ ਦੇ ਵਿੱਚ ਕੀ ਹੁੰਦਾ ਕਿ ਜਿਹੜਾ ਮਨੋਰੰਜਨ ਕਰਨ ਨਾਲ ਹਮੇਸ਼ਾ ਬੰਦੇ ਦਾ ਸਟਰੈਸ ਘੱਟਦਾ ਹੈ ਅਤੇ ਬਹੁਤ ਸਾਰਾ ਸਟਰੈਸ ਘਟਾਉਣ ਦੇ ਵਿੱਚ ਇਹਨੇ ਆਪਣਾ ਹਿੱਸਾ ਪਾਇਆ ਹੈ ਅਤੇ ਫਿਲਮ ਹਲਕੀਆਂ ਫੁਲਕੀਆਂ ਫਿਲਮਾਂ ਨੇ ਹਲਕੇ ਫੁਲਕੇ ਗਾਣੇ ਨੇ ਲੋਕ ਬੜਾ ਸੁਣ ਕੇ ਪੜ੍ਹ ਕੇ ਦੇਖ ਕੇ ਮੈਂ ਬੜਾ ਮਜ਼ਾ ਆਉਂਦਾ ਅਤੇ ਮਨੋਰੰਜਨ ਉਦਯੋਗ ਨੇ ਬਹੁਤ ਆਪਣਾ ਵੱਡਾ ਯੋਗਦਾਨ ਪਾਇਆ ਹੈ